ਹਾਂਜੀ ਮੈਂ ਇੱਕ ਹਫ਼ਤਾ ਪਹਿਲਾਂ ਜਿਹੜੇ ਦੋ ਨੋਵਲ ਮੰਗਵਾਏ ਸੀਗੇ ਇੱਕ ਹੋਰ ਨਵਾਂ ਸਾਲ ਇਸਦੀ ਮੈਨੂੰ ਅੱਜ ਹੀ ਡਿਲੀਵਰੀ ਮਿਲੀ ਹੈ ਅਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਜਦੋਂ ਹੀ ਇਹ ਮੈਨੂੰ ਪ੍ਰਾਪਤ ਹੋਏ ਆ ਤਾਂ ਉਹਦੀ ਪੈਕਿੰਗ ਬਹੁਤ ਸ ਵਧੀਆ ਸੀਗੀ ਅਤੇ ਦੇਖ ਕੇ ਹੀ ਮਨ ਖੁਸ਼ ਹੋ ਗਿਆ ਦੂਸਰਾ ਜਿਹੜੀ ਬੜੀ ਇਹ ਵਾਟਰ ਪਰੂਫ ਜਿਹੜੀ ਪੈਕਿੰਗ ਕੀਤੀ ਹੋਈ ਸੀਗੀ ਜੇ ਕਿਤੇ ਪਾਣੀ ਐਰਾ ਵਗੈਰਾ ਜਾਂ ਬਰਸਾਤ ਦੇ ਮੀਂਹ ਦੇ ਦਿਨਾਂ ਦੇ ਵਿੱਚ ਭਿੱਜ ਕੇ ਖਰਾਬ ਨਾ ਹੋਣ ਇਸ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਖੋਲ੍ਹੀ ਤਾਂ ਹੋਰ ਵੀ ਮੈਨੂੰ ਖੁਸ਼ੀ ਹੋਈ ਕਿ ਮੈਂ ਇਹਨਾਂ ਨੋਵਲਾਂ ਨੂੰ ਪੜ੍ਹਨਾ ਚਾਹੁੰਦਾ ਸੀਗਾ ਚਰਚਾ ਬਹੁਤ ਸੁਣੀ ਸੀਗੀ ਹੁਣ ਜਦੋਂ ਇਹਨਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਖੁਸ਼ੀ ਹੋਈ ਕਿਉਂਕਿ ਮੈਂ ਕਾਫੀ ਦੇਰ ਤੋਂ ਇਹ ਸਰਚ ਕਰ ਰਿਹਾ ਸੀਗਾ ਮੈਨੂੰ ਮਿਲ ਨਹੀਂ ਰਹੇ ਸੀਗੇ ਅਤੇ ਜਦੋਂ ਮੈਂ ਔਂ ਵੈੱਬਸਾਈਟ 'ਤੇ ਤੁਹਾਡੀ 'ਤੇ ਦੇਖੇ ਤਾਂ ਮੈਨੂੰ ਖੁਸ਼ੀ ਹੋਈ ਮੈਂ ਤੁਰੰਤ ਜਿਹੜੇ ਔਡਰ ਕੀਤਾ ਅਤੇ ਹੋਰ ਵੀ ਖੁਸ਼ੀ ਹੋਈ ਬੜੇ ਤੁਸੀਂ ਸਮੇਂ ਸਿਰ ਔਰ ਵਾਜਬ ਰੇਟ ਦੇ ਉੱਤੇ ਇਹ ਜਿਹੜੇ ਮੈਨੂੰ ਪੁੱਜਦੇ ਕੀਤੇ ਆ ਕਿਉਂਕਿ ਜੇ ਮੈਂ ਕਿਸੇ ਤੋਂ ਮੰਗਦਾ ਵੀ ਸੀਗਾ ਤਾਂ ਆਮ ਤੌਰ 'ਤੇ ਇਹਦਾ ਰੇਟ ਜ਼ਿਆਦਾ ਮਿਲਦਾ ਸੀਗਾ ਫੇਰ ਵੀ ਮਿਲ ਨਹੀਂ ਸਕੇ ਅਤੇ ਹੁਣ ਜਦੋਂ ਮੈਂ ਤੁਹਾਡੀ ਵੈੱਬਸਾਈਟ 'ਤੇ ਦੇਖਿਆ ਅਤੇ ਬਹੁਤ ਘੱਟ ਰੇਟ ਦੇ ਵਿੱਚ ਬਹੁਤ ਵਧੀਆ ਜਿਹੜੀ ਪ੍ਰਿੰਟਿੰਗ ਅਤੇ ਜਿਹੜੀ ਇਹਦੀ ਕਵਰੇਜ ਕੀਤੀ ਹੋਈ ਸੀ ਵਧੀਆ ਲੱਗਿਆ ਅਤੇ ਉਸ ਤੋਂ ਵੀ ਖੁਸ਼ੀ ਦੀ ਗੱਲ ਹੈ ਵੀ ਜਦੋਂ ਇਹਨੂੰ ਮੈਂ ਪੜ੍ਹਿਆ ਅਤੇ ਜਿਹੜੀ ਇਹਦੀ ਛਪਾਈ ਹੈ ਨੋਵਲਸ ਦੀ ਇਹ ਬਹੁਤ ਵਧੀਆ ਹੈਗੀ ਅਤੇ ਦੂਸਰਾ ਜਦੋਂ ਇਹ ਨੋਵਲ ਪੜ੍ਹੇ ਆ ਤਾਂ ਮਨ ਬਹੁਤ ਚੰਗਾ ਲੱਗਿਆ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਨਾਵਲ ਪੜ੍ਹ ਕੇ ਬੜਾ ਆਨੰਦ ਆਇਆ ਅਤੇ ਮੈਂ ਆਪਣੇ ਦੋਸਤਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਪੜ੍ਹਾਇਆ ਆ ਅਤੇ ਉਹ ਵੀ ਬਹੁਤ ਖੁਸ਼ ਹੈਗੇ ਆ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਜਦੋਂ ਸਾਨੂੰ ਲੋੜ ਹੋਏਗੀ ਮੈਂ ਹੋਰ ਵੀ ਤੁਹਾਡੀ ਵੈੱਬਸਾਈਟ 'ਤੇ ਬਹੁਤ ਸਾਰੀਆਂ ਕਿਤਾਬਾਂ ਨੋਵਲਸ ਦੇਖੇ ਨੇ ਅਤੇ ਉਹ ਵੀ ਮੈਂ ਇਹ ਔਡਰ ਕਰਨਾ ਚਾਹਾਂਗਾ ਅਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਇਹ ਮੈਨੂੰ ਸਮੇਂ ਸਿਰ ਵਾਜਬ ਰੇਟ ਦੇ ਉੱਤੇ ਬਹੁਤ ਵਧੀਆ ਨੋਵਲ ਜਿਹੜੇ ਪ੍ਰੋਵਾਈਡ ਕਰਵਾਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ